ਹੈਲੋ ਹਾਂਜੀ ਪ੍ਰਕਾਸ਼ ਸਿੰਘ ਜੀ ਭਾਅ ਫਰੂਟ ਵਾਲੀ ਦੁਕਾਨ ਤੋਂ ਬੋਲਦੇ ਜੇ ਹਾਂਜੀ ਸਾਡੇ ਘਰ ਨਾ ਕੋਈ ਪ੍ਰੋਗਰਾਮ ਹੈ ਆ ਅਤੇ ਉਹਦੇ ਵਾਸਤੇ ਸਾਨੂੰ ਫਰੂਟ ਚਾਹੀਦੇ ਆ ਅਤੇ ਤੁਹਾਡੇ ਕੋਲ ਕਿਹੜੇ ਕਿਹੜੇ ਫਰੂਟ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਨੂੰ ਜਿਵੇਂ ਕਿ ਪਪੀਤਾ ਵੀ ਚਾਹੀਦਾ ਅੰਗੂਰ ਅਤੇ ਸੰਗਤਰੇ ਅਤੇ ਸੇਬ ਅਤੇ ਮਤਲਬ ਇਹ ਕਿ ਫਰੂਟ ਵਧੀਆ ਹੋਣੇ ਚਾਹੀਦੇ ਆ ਕੋਈ ਖਰਾਬ ਨਾ ਹੋਵੇ ਫਰੂਟ ਹਾਂਜੀ ਚਲੋ ਠੀਕ ਹੈ ਫਿਰ ਅਸੀਂ ਭੇਜ ਦਿੰਦੇ ਹਾਂ ਅਤੇ ਕਿੰਨੇ ਕੁ ਟਾਈਮ ਤੱਕ ਭੇਜੀਏ ਕਿਤੇ ਹਾਂਜੀ ਨਹੀਂ ਘਰੇ ਨਹੀਂ ਭੇਜਣੇ ਅਸੀਂ ਤੁਹਾਨੂੰ ਦੁਕਾਨ ਤੋਂ ਹੀ ਆਣ ਕੇ ਲੈ ਜਾਣਗੇ ਹਾਂਜੀ ਠੀਕ ਆ ਜੀ ਹਾਂਜੀ